ਅਸੀਂ ਘਰਾਂ ਦੇ ਵਿੱਚ ਗਰਮੀਆਂ ਦੇ ਦਿਨਾਂ 'ਚ ਬਹੁਤ ਠੰਡੀਆਂ ਠੰਡੀਆਂ ਚੀਜ਼ਾਂ ਬਣਾਉਂਦੇ ਹਾਂ ਅਤੇ ਗਰਮੀ ਬਹੁਤ ਹੁੰਦੀ ਹੈ ਅਸੀਂ ਉਹ ਬੱਚਿਆਂ ਸਮੇਤ ਪੀਂਦੇ ਹਾਂ ਫਿਰ ਸਾਨੂੰ ਸ਼ਾਂਤੀ ਮਿਲਦੀ ਹੈ ਨਿੰਬੂ ਪਾਣੀ ਵੀ ਪੀਂਦੇ ਹਾਂ ਰੂਹ ਅਫਜ਼ਾ ਵੀ ਪੀਂਦੇ ਹਾਂ ਸ਼ਰਬਤ ਵੀ ਪੀਂਦੇ ਹਾਂ ਕੋਈ ਮਹਿਮਾਨ ਆਏ ਜਾਏ ਉਹਨੂੰ ਜੋ ਕੁਝ ਕਹੇ ਉਹ ਪਿਲਾਂਦੇ ਹਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਚਾਹ ਜ਼ਰੂਰ ਪਲਾਉਂਦੇ ਹਾਂ ਦੋ ਤਿੰਨ ਵਾਰ ਪੀਤੀ ਜਾਂਦੀ ਹੈ ਜੋ ਨਾ ਵੀ ਮੰਨਣ ਅਸੀਂ ਤਾਂ ਵੀ ਪਲਾਉਂਦੇ ਆ ਉਹਨਾਂ ਨੂੰ ਹਾਂ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ ਉਹ ਤੇ ਕੌਫੀਆਂ ਮੰਗਦੇ ਆ ਫਿਰ ਉਹਨਾਂ ਨੂੰ ਅਸੀਂ ਜ਼ਰੂਰ ਪਿਲਾਉਂਦੇ ਹਾਂ ਹੈਂ ਹਾਂਜੀ ਕਈ ਵਾਰ ਅਸੀਂ ਗਰਮੀਆਂ ਦੇ ਵਿੱਚ ਸਰਦੀਆਂ ਦੇ ਵਿੱਚ ਕੇਸਰ ਵਾਲਾ ਕਾੜਾ ਬਣਾਉਂਦੇ ਹਾਂ ਉਹ ਬੱਚਿਆਂ ਨੂੰ ਵੀ ਪਿਆਉਂਦੇ ਹਾਂ ਆਪ ਵੀ ਪੀਂਦੇ ਹਾਂ ਮਹਿਮਾਨਾ ਨੂੰ ਪਿਲਾ ਪਿਲਾਉਂਦੇ ਹਾਂ ਹਾਂਜੀ

ਗਰਮੀਆਂ 'ਚ ਠੀਕ ਰਹਿੰਦੇ ਨੇ ਸਾਰੇ ਹੀ ਹਾਂਜੀ ਨਿੰਬੂ ਪਾਣੀ ਪਿਲਾਉਂਦੇ ਹਾਂ ਸਭ ਕੁਝ ਕਰਦੇ ਹਾਂ ਗੁਲੂਕੋਸ਼ ਖੁਸ਼ ਹੋ ਜਾਨ ਜੇ ਮਤਲਬ ਜਿਹਦੇ ਨਾਲ ਉਹ ਖੁਸ਼ ਰਹਿਣ